ਮੈਨੂੰ ਲੱਗਦਾ ਹੈ ਕਿ ਮਨੁੱਖ ਨੂੰ ਆਪਣੀ ਜੜ੍ਹਾਂ ਨਾਲ ਹਮੇਸ਼ਾਂ ਜੁੜੇ ਰਹਿਣਾ ਚਾਹੀਦਾ ਹੈ ਜਿਵੇਂ ਕਿ ਗੱਲ ਕਰ ਲਈਏ ਕਲਚਰ ਦੀ ਗੱਲ ਕਰ ਲਈਏ ਧਰਮ ਦੀ ਜੋ ਕਿ ਅੱਜ ਦੇ ਟਾਈਮ 'ਚ ਬਹੁਤ ਹੀ ਜ਼ਰੂਰੀ ਇੱਕ ਗੱਲ ਹੋ ਗਈ ਹੈ ਕਿ ਆਪਾਂ ਆਪਣੇ ਧਰਮ ਨਾਲ਼ ਆਪਣੇ ਕਲਚਰ ਨਾਲ਼ ਜੁੜ ਕੇ ਰਹੀਏ ਬਟ ਅਫ਼ਸੋਸ ਇਹ ਕਹਿਣਾ ਪੈ ਰਿਹਾ ਹੈ ਕਿ ਅੱਜ ਕੱਲ੍ਹ ਦਾ ਨੌਜਵਾਨ ਆਪਣੇ ਕਲਚਰ ਨੂੰ ਆਪਣੇ ਧਰਮ ਨੂੰ ਪਿੱਛੇ ਭੁੱਲ ਕੇ ਓਹ ਅੱਗੇ ਬਾਹਰਲਿਆਂ ਦੇਸ਼ਾਂ ਵਿੱਚ ਵਿਦੇਸ਼ਾਂ ਦੀ ਧਰਤੀ ਵਿੱਚ ਜਾ ਕੇ ਬਾਹਰਲਾ ਸੱਭਿਅਤਾ ਕਲਚਰ ਨੂੰ ਪ੍ਰੋ ਪ੍ਰੋਮੋਟ ਕਰ ਰਿਹਾ ਹੈ ਜੋ ਕਿ ਬਹੁਤ ਹੀ ਗ਼ਲਤ ਗੱਲ ਹੈ ਅੱਜ ਦੇ ਟਾਇਮ 'ਚ ਦੇਖੋ ਜਿੱਥੇ ਵੀ ਆਪਾਂ ਹੋਈਏ ਕੋਈ ਗੱਲ ਨਹੀਂ ਬਟ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਧਰਮ ਨਾਲ਼ ਆਪਣੇ ਕਲਚਰ ਨਾਲ਼ ਆਪਣੇ ਸੱਭਿਅਤਾ ਨਾਲ਼ ਜੁੜ ਕੇ ਰਹੀਏ ਜਿਵੇਂ ਕਿ ਆਪਣਾ ਸਾਡਾ ਸਿੱਖ ਧਰਮ ਇਹੀ ਦਾ ਵਿੱਚ ਵੀ ਦੇਖਿਆ ਜਾਵੇ ਤਾਂ ਕੁਰਬਾਨੀਆਂ ਬਹੁਤ ਸਾਡੇ ਗੁਰੂਆਂ ਨੇ ਪੀਰਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਅਤੇ ਸਾਨੂੰ ਲੋੜ ਹੈ ਅੱਜ ਦੇ ਟਾਈਮ 'ਚ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਵੀ ਉਹਦੇ ਬਾਰੇ ਜਾਗਰੂਕ ਕਰੀਏ ਕਿ ਆਪਣੇ ਧਰਮ ਨਾਲ਼ ਆਪਣੇ ਸੱਭਿਅਤਾ ਨਾਲ਼ ਕਲਚਰ ਨਾਲ਼ ਆਪਾਂ ਜੁੜ ਕੇ ਰਹੀਏ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਵਾਰ ਮੈਂ ਆਪਣੇ ਬਚਪਨ ਦੀ ਗੱਲ ਹੈ ਕਿ ਜਦੋਂ ਮੈਂ ਪੰਜਵੀਂ ਕਲਾਸ 'ਚ ਪੜ੍ਹਦਾ ਸੀ ਉਸ ਟਾਈਮ ਮੈਂ ਇੱਕ ਭੰਗੜੇ 'ਚ ਕੰਪੀਟੀਸ਼ਨ 'ਚ ਹਿੱਸਾ ਲਿਆ ਸੀ ਉਸ ਟਾਈਮ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਕਿ ਮੈਂ ਆਪਣੇ ਧਰਮ ਆਪਣੇ ਕਲਚਰ ਨੂੰ ਆਪਣੇ ਸੱਭਿਅਤਾ ਨੂੰ ਪ੍ਰਮੋਟ ਕਰ ਰਿਹਾ ਹਾਂ ਜਿਵੇਂ ਕਿ ਉਹਦੇ ਪਿੱਛੇ ਸਾਡਾ ਪੰਜਾਬੀ ਵਿਰਸਾ ਦਰਸਾਇਆ ਗਿਆ ਸੀ ਕਿਉਂਕਿ ਅਜੋਕੇ ਸਮੇਂ ਵਿੱਚ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਤਾਂ ਬੱਚੇ ਬਹੁਤ ਹੀ ਇਸ ਤੋਂ ਦੂਰ ਹੁੰਦੇ ਜਾ ਰਹੇ ਨੇ ਬਟ ਸਾਨੂੰ ਚਾਹੀਦਾ ਹੈ ਕਿ ਅਸੀਂ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਨਸਲਾਂ ਨੂੰ ਆਪਣੇ ਧਰਮ ਬਾਰੇ ਆਪਣੇ ਕਲਚਰ ਬਾਰੇ ਪ੍ਰਮੋਟ ਕਰੀਏ